ਸਤਿ ਸ੍ਰੀ ਅਕਾਲ ਸਰ ਮੈਨੂੰ ਸੂਚਨਾ ਮਿਲੀ ਹੈ ਕਿ ਮੇਰੇ ਪ੍ਰੀਪੇਡ ਖਾਤੇ ਵਿੱਚ ਬਹੁਤ ਘੱਟ ਬਕਾਇਆ ਹੈ ਮੈਨੂੰ ਨਹੀਂ ਲੱਗਦਾ ਕਿ ਮੇਰੇ ਖਾਤੇ ਵਿੱਚ ਇੰਨਾਂ ਘੱਟ ਬਕਾਇਆ ਹੋ ਸਕਦਾ ਹੈ ਸੋ ਸੋ ਕ੍ਰਿਪਾ ਕਰਕੇ ਮੇਰੇ ਖਾਤੇ ਵਿੱਚ ਸਹੀ ਰਕਮ ਮੈਨੂੰ ਦੱਸੀ ਜਾਵੇ ਤਾਂ ਜੋ ਮੈਂ ਜਾਣੂ ਹੋ ਸਕਾਂ ਕਿ ਮੇਰੇ ਪ੍ਰੀਪੇਡ ਖਾਤੇ ਵਿੱਚ ਕਿੰਨੀ ਰਕਮ ਹੈ ਤਾਂ ਜੋ ਮੈਂ ਉਸ ਹਿਸਾਬ ਨਾਲ ਆਪਣੀਆਂ ਟਰਾਂਜੈਕਸ਼ਨ ਕਰ ਸਕਾਂ ਮੇਰੇ ਖਾਤੇ ਨਾਲ ਲਿੰਕ ਮੇਰਾ ਮੋਬਾਈਲ ਨੰਬਰ ਇਸ ਪ੍ਰਕਾਰ ਹੈ ਨੌ ਪੰਜ ਸੱਤ ਛੇ ਪੰਜ ਨੌ ਸੱਤ ਅੱਠ ਨੌ ਇੱਕ ਹੈ ਸੋ ਕਿਰਪਾ ਕਰਕੇ ਮੈਨੂੰ ਇਸ ਨਾਲ ਸੰਬੰਧਿਤ ਸਾਰੇ ਵੇਰਵੇ ਦੀ ਸੂਚਨਾ ਦਿੱਤੀ ਜਾਵੇ ਧੰਨਵਾਦ